ਮੈਨੂੰ ਡਾਂਸ ਬਹੁਤ ਪਸੰਦ ਹੈ ਜਦੋਂ ਵੀ ਮੈਂ ਵਿਹਲੀ ਹੁੰਦੀ ਹਾਂ ਤਾਂ ਮੈਂ ਡਾਂਸ ਰੀਲਾਂ ਦੇਖਦੀ ਹਾਂ ਸ਼ੋਸ਼ਲ ਮੀਡੀਆ 'ਤੇ ਬਹੁਤ ਸਾਰੇ ਡਾਂਸਰ ਹਨ ਪਰ ਮੈਨੂੰ ਸ਼ਕਤੀ ਮੋਹਨ ਬਹੁਤ ਪਸੰਦ ਹੈ ਉਹ ਬਹੁਤ ਵਧੀਆ ਡਾਂਸ ਕਰਦੀ ਹੈ ਉਹ ਇੱਕ ਇੰਡੀਅਨ ਬੈਸਟ ਡਾਂਸਰ ਹੈ ਮੈਨੂੰ ਉਹਨਾਂ ਤੋਂ ਹੀ ਪ੍ਰੇਰਨਾ ਮਿਲੀ ਹੈ ਕਿ ਮੈਨੂੰ ਡਾਂਸ ਕਰਦੇ ਰਹਿਣਾ ਚਾਹੀਦਾ ਹੈ ਜਿਹਦੇ ਕਰਕੇ ਮੈਂ ਇੱਕ ਦਿਨ ਆਪਣੀ ਮੰਜ਼ਿਲ 'ਤੇ ਜ਼ਰੂਰ ਪਹੁੰਚ ਜਾਵਾਂਗੀ